ਡਾਂਸ ਹੈ ਜਿਹੜਾ ਉਹ ਸੁਰ ਅਤੇ ਤਾਲ ਦਾ ਸੰਗਮ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਨਾਚ ਦੇ ਲਈ ਕੋਈ ਵੀ ਨਾਚ ਹੈ ਚਾਹੇ ਉਹ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਮੈਂ ਇਹ ਚੂਜ਼ ਕਰਦੀ ਹੈਗੀ ਕਿ ਮੈਂ ਕਿਸ ਤਰੀਕੇ ਦਾ ਨਾਚ ਹੈ ਜਿਹੜਾ ਉਹ ਨੱਚਣਾ ਮੇਰੇ ਅੰਦਰਲੇ ਮਨੋਭਾਵ ਕੀ ਨੇ ਉਸ ਵਕਤ ਮੇਰਾ ਮੂਡ ਕੀ ਹੈ ਮੈਂ ਕੀ ਚੀਜ਼ ਹੈ ਮੇਰੇ ਅੰਦਰ ਜੋ ਮੈਂ ਬਾਹਰ ਦਿਖਾਉਣਾ ਚਾਹੁੰਦੀ ਹਾਂ ਉਸ ਮਨੋਭਾਵਾਂ 'ਤੇ ਅਧਾਰਿਤ ਮੈਂ ਸੰਗੀਤ ਹੈ ਜਿਹੜਾ ਉਹ ਚੁਣਦੀ ਹਾਂ ਜੇਕਰ ਮੈਂ ਖੁਸ਼ ਹਾਂ ਤਾਂ ਮੈਂ ਮੇਰੀ ਖੁਸ਼ੀ ਨੂੰ ਕਿਸ ਤਰ੍ਹਾਂ ਦੇ ਸੰਗੀਤ ਦੇ ਰਾਹੀਂ ਪ੍ਰਗਟ ਕਰਨਾ ਉਹਦੇ ਕੀ ਬੋਲ ਹੋਣੇ ਚਾਹੀਦੇ ਹੈਗੇ ਕਿ ਉਹਦੀ ਜਿਹੜੀ ਲੈਅ ਆ ਉਹ ਹੋਣੀ ਚਾਹੀਦੀ ਹੈਗੀ ਮੈਂ ਉਸ ਅਕੋਰਡਿੰਗ ਉਸ ਚੀਜ਼ ਨੂੰ ਜਿਹੜਾ ਉਹ ਚੁਣਦੀ ਹਾਂ ਇਸ ਤੋਂ ਇਲਾਵਾ ਜੇਕਰ ਮੈਂ ਦੁਖੀ ਹਾਂ ਤਾਂ ਮੈਂ ਕਿਸ ਤਰੀਕੇ ਦਾ ਸੰਗੀਤ ਆ ਜਿਹੜਾ ਉਹ ਚੁਣਨਾ ਹੈਗਾ ਇਹਨਾਂ ਸਾਰਿਆਂ ਦੀ ਸੰਗਮਤਾ ਜਿਹੜੀ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਨ ਜੇਕਰ ਅਸੀਂ ਮੈਂ ਗੱਲ ਕਰਾਂ ਮੇਰੀ ਤਾਂ ਨਸ ਕਾਲਜ ਦੇ ਵਿੱਚ ਕਿਸ ਤਰੀਕੇ ਦਾ ਕੋਈ ਫੰਕਸ਼ਨ ਹੈ ਚੱਲ ਰਿਹਾ ਹੈਗਾ ਉੱਥੇ ਮੈਂ ਕਿਸ ਤਰੀਕੇ ਦੀ ਜਿਹੜੀ ਆਈਟਮ ਹੈ ਉਹ ਪ੍ਰਸਤੁਤ ਕਰਨੀ ਹੈਗੀ ਇਹ ਵੀ ਬਹੁਤ ਜ਼ਿਆਦਾ ਜਰੂਰੀ ਹੈ ਸੋ ਮੌਕੇ ਦੇ ਅਨੁਸਾਰ ਵੀ ਜਿਹੜਾ ਗੀਤ ਹੈਗਾ ਸੰਗੀਤ ਹੈਗਾ ਉਹ ਮੈਂ ਚੁਣਦੀ ਹਾਂ